ਹਾਂਜੀ ਸਰਕਾਰ ਤੋਂ ਮਿਲਣ ਵਾਲੇ ਲਾਭ ਕਾਰਜਾਂ ਬਾਰੇ ਮੈਨੂੰ ਸਾਰੀ ਨੌਲੇਜ ਹੈ ਜਿਵੇਂ ਕਿ ਸਾਡੇ ਸ ਖੇਤਾਂ ਵਿੱਚ ਪਾਣੀ ਦੀ ਮੋਟਰ ਲੱਗੀ ਹੋਈ ਹੈ ਉਸ ਦਾ ਬਿੱਲ ਮਾਫ ਹੈ ਸਾਨੂੰ ਸਰਕਾਰ ਤੋਂ ਕਰਜ਼ਾ ਬਹੁਤ ਘੱਟ ਵਿਆਜ ਦੀ ਦਰ ਨਾਲ ਪ੍ਰਾਪਤ ਹੋ ਜਾਂਦਾ ਹੈ ਐਗਰੀਕਲਚਰ ਤੋਂ ਸਾਨੂੰ ਬਹੁਤ ਘੱਟ ਰੇਟਾਂ ਨਾਲ ਬੀਜ ਸਪਰੇਅ ਸਾਰੀਆਂ ਦਵਾਈਆਂ ਬਹੁਤ ਘੱਟ ਰੇਟ ਨਾਲ ਮਿਲ ਜਾਂਦੀਆਂ ਹਨ ਔਰ ਮੈਂ ਇਹ ਸਰਕਾਰ ਤੋਂ ਇਹ ਉਮੀਦ ਕਰਦੀ ਹਾਂ ਕਿ ਜਿਹੜਾ ਕਰਜ਼ਾ ਕਿਸਾਨਾਂ ਨੂੰ ਮਿਲਦਾ ਹੈ ਉਸ ਦਾ ਵਿਆਜ ਹੋਰ ਵੀ ਘੱਟ ਤੋਂ ਘੱਟ ਕੀਤਾ ਜਾਵੇ